ਹੈਲੋ ਹਾਂਜੀ ਪੂਨਮ ਬੋਲਦੇ ਹੋ ਹਾਂਜੀ ਪੂਨਮ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਫਾਜ਼ਿਲਕਾ ਡਿਸਟਰਿਕ ਦੇ ਵਿੱਚ ਕੀ ਇਮਪਰੂਵਮੈਂਟ ਹੋ ਰਿਹਾ

ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਠੀਕ ਠੀਕ ਠੀਕ ਹੈ ਹੋਰ ਕੀ ਇੰਪਰੂਵਮੈਂਟ ਹੋਣੀ ਹੈ ਜੀ ਤੁਹਾਡੇ ਫਾਜ਼ਿਲਕਾ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਮੈਮ ਚਲੋ ਬਹੁਤ ਬਹੁਤ ਥੈਂਕ ਯੂ ਫੋਰ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ